ਮੈਨੂੰ ਆਪਣੇ ਕਾਲਜ ਦਾ ਟਾਈਮ ਤੋਂ ਹੀ ਬਾਈਕ 'ਤੇ ਜਾਣਾ ਬਹੁਤ ਪਸੰਦ ਹੈ ਮੈਂ ਬਾਈਕ ਚਲਾਉਣਾ ਹੀ ਪ੍ਰੈਫਰ ਕਰਦਾ ਜਦੋਂ ਵੀ ਮੈਂ ਕਿਤੇ ਵੀ ਜਾਣਾ ਹੋਵੇ ਪ੍ਰੰਤੂ ਅੱਜ ਦੇ ਦੌਰ ਵਿੱਚ ਟਰੈਫਿਕ ਜਾਮ ਸ਼ਹਿਰਾਂ ਦੀ ਸਭ ਤੋਂ ਵੱਡੀ ਸਮੱਸਿਆ ਬਣ ਕੇ ਉੱਭਰ ਰਿਹਾ ਹੈ ਸੜਕਾਂ 'ਤੇ ਲੱਗੀਆਂ ਬੇਅੰਤ ਵਾਹਨਾਂ ਦੀਆਂ ਕਤਾਰਾਂ ਕਾਰਨ ਹਰ ਸ਼ਹਿਰ ਵਾਸੀ ਨੂੰ ਟਰੈਫਿਕ ਜਾਮ ਦੀ ਸਮੱਸਿਆ ਵਿੱਚੋਂ ਲੰਘਣਾ ਪੈਂਦਾ ਹੈ ਅੱਜ ਹਰ ਕੋਈ ਆਪਣਾ ਵਾਹਨ ਨਾਲ ਘਰੋਂ ਨਿਕਲਦਾ ਹੈ ਚਾਹੇ ਉਹ ਖਰੀਦਦਾਰੀ ਲਈ ਹੋਵੇ ਜਾਂ ਸਕੂਲ ਜਾਂ ਦਫ਼ਤਰ ਜਾਣ ਲਈ ਕੋਈ ਵੀ ਪੈਦਲ ਨਹੀਂ ਜਾਣਾ ਚਾਹੁੰਦਾ ਨਿੱਜੀ ਵਾਹਨਾਂ ਅਤੇ ਤੇਜ਼ ਵਿਕਾਸ ਲਈ ਮੋਟਰ ਸਾਈਕਲਾਂ ਅਤੇ ਕਾਰਾਂ ਦੀ ਗਿਣਤੀ ਸਭ ਤੋਂ ਵੱਧ ਹੈ ਇਹ ਵਾਹਨ ਵੱਡੇ ਪੱਧਰ 'ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਨ ਤੇਜ਼ ਰਫਤਾਰ ਵਾਹਨ ਸ਼ਹਿਰਾਂ ਅਤੇ ਮਹਾਂ ਨਗਰਾਂ ਵਿੱਚ ਟਰੈਫਿਕ ਜਾਮ ਦਾ ਕਾਰਨ ਹਨ ਟ੍ਰੈਫਿਕ ਜਾਮ ਕਾਰਨ ਸ਼ਹਿਰਾਂ ਵਿੱਚ ਲੋਕ ਨਾ ਤਾਂ ਸਮਾਂ ਬੰਦ ਕੰਮ ਆਪਾਂ ਕਰ ਪਾਉਂਦੇ ਹਨ ਅਤੇ ਨਾ ਹੀ ਸਮੇਂ ਸਿਰ ਦਫ਼ਤਰ ਪਹੁੰਚ ਪਾਉਂਦੇ ਹਨ ਇਸ ਕਾਰਨ ਉਹਨਾਂ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਘਰ ਛੱਡਣਾ ਪੈਂਦਾ ਹੈ ਅੱਜ ਇਹ ਹਰ ਵੱਡੇ ਸ਼ਹਿਰ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੁਸੀਬਤ ਬਣ ਗਿਆ ਹੈ ਕਈ ਕਈ ਘੰਟੇ ਵਾਹਨਾਂ ਦੀ ਇਸ ਭੀੜ ਵਿੱਚ ਫਸੇ ਰਹਿਣ ਕਾਰਨ ਲੋਕ ਸੜਕਾਂ 'ਤੇ ਹੀ ਆਪਣਾ ਕੀਮਤੀ ਸਮਾਂ ਬਰਬਾਦ ਕਰ ਦਿੰਦੇ ਹਨ ਬਾਈਕ ਚਲਾਉਂਦੇ ਸਮੇਂ ਸੜਕਾਂ 'ਤੇ ਅਨੇਕਾਂ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਤੰਗ ਸੜਕਾਂ ਹਨ ਸੜਕਾਂ 'ਤੇ ਟਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਆਵਾਜਾਈ ਦੇ ਸਾਧਨ ਘੱਟ ਹਨ ਟੁੱਟੀਆਂ ਫੁੱਟੀਆਂ ਸੜਕਾਂ ਹਨ ਸੜਕਾਂ 'ਤੇ ਖੱਡੇ ਬਹੁਤ ਹਨ ਸੜ ਕੱਚੀਆਂ ਸੜਕਾਂ ਬਹੁਤ ਹਨ ਜੰਗਲੀ ਜਾਨਵਰ ਆਦਿ ਇੱਕ ਦਮ ਮੂਹਰੇ ਆ ਜਾਂਦੇ ਆ ਜਿਹਨਾਂ ਕਰਕੇ ਐਕਸੀਡੈਂਟ ਹੋਣ ਦਾ ਖਤਰਾ ਵੱਧ ਜਾਂਦਾ ਹੈ